ਜੀ ਹਾਂ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਇਲੈਕਟਰਿਕ ਮੋਟਰ ਵਰਤੀ ਜਾ ਸਕਦੀ ਹੈ ਇਹ ਡਿਪੈਂਡ ਕਰੇਗਾ ਕਿ ਤੁਸੀਂ ਖੂਹ ਦੀ ਨੀਵਾਈਂ ਕਿੰਨੀ ਹੈ ਪਾਣੀ ਕਿੰਨਾ ਕੁ ਡੂੰਘਾ ਹੈ ਜੇ ਤਾਂ ਨੋਰਮਲ ਹੈ ਜਿੱਦਾਂ ਦੋ ਮੰਜ਼ਿਲਾਂ ਬਿਲਡਿੰਗ ਜਿੰਨਾ ਤਾਂ ਇੱਕ ਹੋਰਸ ਪਾਵਰ ਦੀ ਮੋਟਰ ਦੇ ਨਾਲ ਤੁਸੀਂ ਇਸਨੂੰ ਪਾਣੀ ਨੂੰ ਕੱਢ ਸਕਦੇ ਹੋ ਮੋਟਰ ਦੀ ਜਿਹੜੀ ਇੰਨਲੈਟ ਪਾਈਪ ਹੈ ਉਹਨੂੰ ਉਹਦੇ ਨਾਲ ਪਲਾਸਟਿਕ ਦੀ ਪਾਈਪ ਜਿਹੜੀ ਰਬੜ ਪਾਈਪ ਹੁੰਦੀ ਹੈ ਉਹ ਜੋੜ ਕੇ ਖੂਹ ਦੇ ਵਿੱਚ ਜਿੱਥੇ ਤੱਕ ਪਾਣੀ ਹੈ ਉਹਦੇ ਅੰਦਰ ਸੁੱਟ ਦਿਓ ਅਤੇ ਮੋਟਰ ਨੂੰ ਕਨੈਕਸ਼ਨ ਦੇ ਕੇ ਚਲਾ ਲਓ ਅਤੇ ਉਸ ਤੋਂ ਬਾਅਦ 'ਚੋਂ ਮੋਟਰ ਜਦੋਂ ਚੱਲੇਗੀ ਤਾਂ ਨੀਚਿਓ ਪਾਣੀ ਆਪਣੇ ਆਪ ਚੁੱਕਣਾ ਸ਼ੁਰੂ ਕਰ ਦੇਵੇਗੀ ਅਤੇ ਅਗਲੇ ਪਾਸਿਓ ਪਾਣੀ ਬਾਹਰ ਆ ਜਾਵੇਗਾ